ਹੈਲੋ ਹਾਂਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬੋਲੋ ਬੱਚੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਜ਼ਰੂਰ ਬੇਟਾ ਦੇਖੋ ਆਪਣੇ ਜਦੋਂ ਆਜ਼ਾਦੀ ਦਾ ਸਮਾਂ ਸੀਗਾ ਤਾਂ ਸਭ ਤੋਂ ਜ਼ਿਆਦਾ ਜਿਹੜੀਆਂ ਸ਼ਹੀਦੀਆਂ ਉਹ ਆਪਣੇ ਪੰਜਾਬ 'ਚੋਂ ਹੀ ਸੀਗੇ ਜਿਹਨਾਂ ਨੇ ਦਿੱਤੀਆਂ ਸੀਗੀਆਂ ਉਹਨਾਂ ਵਿੱਚ ਬਹੁਤ ਸਾਰੇ ਸੁਤੰਤਰਤਾ ਸੈਨਾਨੀ ਆ ਜਾਂਦੇ ਆ ਜਿਵੇਂ ਕਿ ਭਗਤ ਸਿੰਘ ਊਧਮ ਸਿੰਘ ਲਾਲਾ ਲਾਜਪਤ ਰਾਏ ਹੋ ਗਏ ਰਾਜਗੁਰੂ ਹੋ ਗਏ ਸੁਖਦੇਵ ਹੋ ਗਏ ਠੀਕ ਹੈ ਅਤੇ ਹੁਣ ਆਪਾਂ ਇਹਨਾਂ ਬਾਰੇ ਇੱਕ ਇੱਕ ਕਰਕੇ ਜਾਣਕਾਰੀ ਤੁਹਾਨੂੰ ਦਿੰਦੇ ਹਾਂ ਭਗਤ ਸਿੰਘ ਉੱਨੀ ਸੌ ਸੱਤ ਤੋਂ ਲੈ ਕੇ ਇਕੱਤੀ ਤੱਕ ਇਹਨਾਂ ਦਾ ਜਨਮ ਕਾਲ ਰਿਹਾ ਹੈ ਜਿਹੜਾ ਸਭ ਤੋਂ ਭਾਰਤ ਦੇ ਜਿਹੜੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਕ੍ਰਾਂਤੀਕਾਰੀ ਸੀਗੇ ਉਹਨਾਂ ਵਿੱਚੋਂ ਇੱਕ ਭਗਤ ਸਿੰਘ ਸੀਗੇ ਅਤੇ ਇਹਨਾਂ ਨੇ ਖ਼ਾਸ ਕਰਕੇ ਬ੍ਰਿਟਿਸ਼ ਹਕੂਮਤ ਦੇ ਖਿਲਾਫ ਬਹੁਤ ਜ਼ਿਆਦਾ ਸੰਘਰਸ਼ ਕੀਤਾ ਉੱਨੀ ਸੌ ਅਠਾਈ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਉਹਨਾਂ ਨੇ ਸਾਡਰਸ ਦੀ ਵੀ ਹੱਤਿਆ ਕੀਤੀ ਉੱਨੀ ਸੌ ਉਣੱਤੀ ਵਿੱਚ ਦਿੱਲੀ ਅਸੈਂਬਲੀ ਵਿੱਚ ਬੰਬ ਫੈਂਕਿਆ ਸੁੱਟਿਆ ਉਹਨਾਂ ਨੇ ਉੱਨੀ ਸੌ ਇਕੱਤੀ ਵਿੱਚ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਉਹਨਾਂ ਨੂੰ ਵੀ ਫਾਂਸੀ ਦਿੱਤੀ ਗਈ ਇਸ ਤੋਂ ਬਾਅਦ ਆ ਜਾਂਦੇ ਨੇ ਊਧਮ ਸਿੰਘ ਅਠਾਰਾਂ ਸੌ ਨੜਿਨਵੇਂ ਤੋਂ ਲੈ ਕੇ ਉੱਨੀ ਸੌ ਚਾਲੀ ਤੱਕ ਦਾ ਉਹਨਾਂ ਦਾ ਕਾਲ ਰਿਹਾ ਅਤੇ ਜਿਵੇਂ ਕਿ ਆਪਾਂ ਜਾਣਦੇ ਵੀ ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਉੱਨੀ ਸੌ ਉੱਨੀ ਵਿੱਚ ਜਦੋਂ ਹੋਇਆ ਸੀ ਕਹਿੰਦੇ ਉਸ ਚੀਜ਼ ਦਾ ਬਦਲਾ ਲੈਣ ਲਈ ਹੀ ਉੱਨੀ ਸੌ ਚਾਲੀ ਵਿੱਚ ਲੰਡਨ 'ਚ ਮਾਈਕਲ ਉਡਾਈਰ ਨੂੰ ਉਹਨਾਂ ਨੇ ਗੋਲੀ ਮਾਰ ਦਿੱਤੀ ਸੀ ਠੀਕ ਹੈ ਇਸ ਇਸਦੇ ਖਿਲਾਫ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਨੇ ਫਾਂਸੀ ਦੇ ਦਿੱਤੀ ਸੀਗੀ ਠੀਕ ਆ ਸਮਝ ਆਇਆ ਬੇਟੇ ਜਿੰਨਾ ਕੁ ਮੈਂ ਦੱਸਿਆ ਤੁਹਾਨੂੰ ਬੇਟਾ ਹਾਂਜੀ ਫਿਰ ਇਸ ਤੋਂ ਬਾਅਦ ਆਪਾਂ ਗੱਲ ਕਰ ਸਕਦੇ ਹਾਂ ਲਾਲਾ ਲਾਜਪਤ ਰਾਏ ਜੀ ਬਾਰੇ ਅਠਾਰਾਂ ਸੌ ਪੈਂਹਟ ਤੋਂ ਲੈ ਕੇ ਉੱਨੀ ਸੌ ਅਠਾਈ ਤੱਕ ਦਾ ਉਹਨਾਂ ਦਾ ਜਨਮ ਕਾਲ ਰਿਹਾ ਅਤੇ ਲਾਲਾ ਲਾਜਪਤ ਰਾਏ ਨੂੰ ਪੰਜਾਬ ਕੇਸਰੀ ਦੇ ਨਾਮ ਨਾਲ ਹੁਣ ਜਾਣਿਆ ਜਾਂਦਾ ਸੀਗਾ ਉਹਨਾਂ ਨੇ ਆਜ਼ਾਦੀ ਲਈ ਬਹੁਤ ਹੀ ਮੁੱਖ ਭੂਮਿਕਾ ਨਿਭਾਈ ਸਾਈਮਨ ਕਮੀਸ਼ਨ ਦਾ ਵਿਰੋਧ ਦੇ ਵਿੱਚ ਜਦੋਂ ਉਹਨਾਂ ਨੇ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਨੇ ਉਹਨਾਂ 'ਤੇ ਬਹੁਤ ਹੀ ਲਾਠੀਚਾਰਜ ਕੀਤੀ ਜਿਹਦੇ ਨਾਲ ਉਹ ਘਾਇਲ ਹੋ ਗਏ ਬਹੁਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਘਾਇਲ ਹੋ ਗਏ ਫਿਰ ਉਹਨਾਂ ਦੀ ਮ੍ਰਿਤੂ ਹੋ ਗਈ ਅਤੇ ਇਸ ਤਰ੍ਹਾਂ ਹੋਰ ਵੀ ਬਹੁਤ ਜ਼ਿਆਦਾ ਹੈਗੇ ਹੈ ਆਜ਼ਾਦੀ ਲਈ ਲੜਨ ਵਾਲੇ ਆਪਣੇ ਪੰਜਾਬ ਦੇ ਫਰੀਡਮ ਫਾਈਟਰਸ ਜਿਵੇਂ ਕਿ ਕਿਰਮਲ ਸਿੰਘ ਹੋ ਗਏ ਬਾਬਾ ਰਾਮ ਸਿੰਘ ਹੋ ਗਏ ਅਤੇ ਹੋਰ ਜੇ ਤੁਸੀਂ ਕਹੋ ਤਾਂ ਮੈਂ ਦੱਸ ਸਕਦੀ ਹਾਂ ਜੇ ਤੁਹਾਡੇ ਕੋਲ ਸਮਾਂ ਹੈਗਾ ਨਹੀਂ ਤਾਂ ਇੰਨਾ ਕੁ ਵੀ ਤੁਸੀਂ ਬੋਲ ਸਕਦੇ ਹੋ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਮੈਂ ਤੁਹਾਨੂੰ ਸ਼ਾਰਟ ਵਿੱਚ ਇਤਿਹਾਸ ਉਹਨਾਂ ਦਾ ਦੱਸਿਆ ਹਾਂਜੀ ਠੀਕ ਹੈ ਜੀ ਓਕੇ ਓਕੇ ਓਕੇ ਜੀ ਵੈਲਕਮ ਜੀ